ਮੁਰਗੀਆਂ ਨੂੰ ਬਹੁਤ ਸਾਰੀਆਂ ਫੀਡਾਂ ਪਾਈਆਂ ਜਾਂਦੀਆਂ ਹਨ ਜਿਵੇਂ ਕਿ ਕਣਕ ਚੌਲ ਮੱਕੀ ਬਾਜਰਾ ਮੂੰਗੀ ਜਿਵੇਂ ਕਿ ਦਾਲਾਂ ਬਹੁਤ ਸਾਰੀਆਂ ਦਾਲਾਂ ਸਾਡੀਆਂ ਖਰਾਬ ਹੋ ਜਾਂਦੀਆਂ ਹਨ ਉਹ ਵੀ ਅਸੀਂ ਮੁਰਗੀਆਂ ਨੂੰ ਫੀਡ ਦੇ ਤੌਰ 'ਤੇ ਹੀ ਪਾ ਦਿੰਦੇ ਹਾਂ ਜਦੋਂ ਅਸੀਂ ਇਹਨਾਂ ਨੂੰ ਖੁੱਲ੍ਹਾ ਛੱਡਦੇ ਹਾਂ ਕੁਝ ਫੀਡ ਇਹ ਆਪਣੇ ਆਪ ਚੁਗ ਲੈਂਦੀਆਂ ਹਨ ਜੋ ਇਹਨਾਂ ਦੇ ਮਨ ਪਸੰਦ ਦੀ ਹੁੰਦੀ ਹੈ ਜਿਵੇਂ ਕਿ ਕੰਕਰ ਕੰਚ ਉਹ ਇਹਨਾਂ ਦੀ ਇਹਨਾਂ ਦੇ ਵਿਕਾਸ ਵਾਸਤੇ ਬਹੁਤ ਹੀ ਲਾਹੇਵੰਦ ਹੁੰਦਾ ਹੈ ਇਹ ਚੀ ਇਹ ਫੀਡਾਂ ਫਸਲਾਂ ਤੋਂ ਹੀ ਤਿਆਰ ਕੀਤੀਆਂ ਜਾਂਦੀਆਂ ਹਨ ਕੁਝ ਫੀਡਾਂ ਬਾਜ਼ਾਰੋਂ ਮੁੱਲ ਵੀ ਲਿਆਂਦੀਆਂ ਜਾਂਦੀਆਂ ਹਨ ਜਿਸ ਨਾਲ ਉਹਨਾਂ ਦਾ ਵਿਕਾਸ ਬਹੁਤ ਹੀ ਤੇਜ਼ੀ ਨਾਲ ਹੁੰਦਾ ਹੈ